ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅਸੀਂ ਵੀ ਹਾਂਜੀ ਹਾਂਜੀ ਅਸੀਂ ਵੀ ਹਾਂਜੀ ਸੋਚਦੇ ਪਏ ਸੀਗੇ ਕਿ ਚਲੋ ਸਲਾਹ ਕਰਕੇ ਮਤਲਬ ਜਿਹੜਾ ਕੋਈ ਅੱਛਾ ਸਕੂਲ ਹੈ ਜੋ ਬੱਚੇ ਦੇ ਭਵਿੱਖ ਨੂੰ ਲੈ ਕੇ ਡਿਸਪਲਿਨ ਵਗੈਰਾ ਵਧੀਆ ਹੋਵੇ ਜੋ ਵੀ ਅਤੇ ਮਤਲਬ ਉਹ ਸਕੂਲ 'ਚ ਪਾਇਆ ਜਾਵੇ ਅਤੇ ਤਰਨ ਤਾਰਨ ਸ਼ਹਿਰ ਦੇ ਵਿੱਚ ਕਿਉਂਕਿ ਆਪਾਂ ਨੂੰ ਥੋੜ੍ਹਾ ਨਜ਼ਦੀਕ ਵੀ ਪੈਂਦਾ ਕਿ ਜ਼ਿਲ੍ਹਾ ਵੀ ਹੈ ਅਤੇ ਕਾਫੀ ਸਹੂਲਤਾਂ ਵੀ ਇਹਦੇ ਵਿੱਚ ਪੀ ਸੀ ਏ ਦਾ ਮਤਲਬ ਮੈਂ ਸੁਣਿਆ ਸੀ ਪੰਜਾਬ ਚਿਲਡਰਨ ਅਕੈਡਮੀ ਜਿਹੜੀ ਮਤਲਬ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਸਾਡੇ ਵੀ ਮਤਲਬ ਰਿਸ਼ਤੇਦਾਰ ਇੱਥੋਂ ਮਤਲਬ ਪੀ ਸੀ ਏ ਬੱਚੇ ਜਾ ਰਹੇ ਆ ਅਤੇ ਮਤਲਬ ਕਿ ਬੱਚਿਆਂ ਦੀ ਸਟੱਡੀ ਅਤੇ ਬੱਚਿਆਂ ਦੇ ਮਤਲਬ ਬੋਲ ਚਾਲ ਦੇ ਤਰੀਕੇ ਨੂੰ ਲੈ ਕੇ ਕਾਫੀ ਮਤਲਬ ਕਿ ਪਤਾ ਲੱਗਦਾ ਕਿ ਬੱਚੇ ਕਿਸੇ ਅੱਛੇ ਸਕੂਲ ਦੇ ਵਿਦਿਆਰਥੀ ਹੈਗੇ ਆ ਹਾਂਜੀ ਅਤੇ ਇ ਹਾਂਜੀ ਹਾਂਜੀ ਜ਼ਰੂਰ ਹਾਂਜੀ ਜ਼ਰੂਰ ਹਾਂ ਠੀਕ ਹੈ ਓਕੇ ਓਕੇ